ਮੇਰਾ ਆਪਣੀ ਮਲਕੀਅਤ ਵਾਲਾ ਸਭ ਤੋਂ ਪਹਿਲਾ ਫ਼ੋਨ ਨੋਕੀਆ ਦਾ ਹੁੰਦਾ ਸੀ ਜੋ ਕਿ ਬਟਨਾਂ ਵਾਲਾ ਫ਼ੋਨ ਸੀ ਉਹ ਬੜਾ ਵਧੀਆ ਫ਼ੋਨ ਹੁੰਦਾ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਐਪ ਡਾਊਨਲੋਡ ਨਹੀਂ ਸੀ ਹੁੰਦੀ ਕੁਛ ਨਹੀਂ ਸੀ ਹੁੰਦਾ ਫ਼ੋਨ ਸੁਣੋ ਅਤੇ ਕਰੋ ਮੈਸੇਜਿਜ਼ ਆਉਂਦੇ ਹੁੰਦੇ ਸਨ ਕੁਛ ਨਹੀਂ ਸੀ ਹੁੰਦਾ ਹੁਣ ਦੇ ਸਮੇਂ ਦੇ ਵਿੱਚ ਸਮਾਰਟਫ਼ੋਨ ਆਉਣ ਕਰਕੇ ਬੜੀਆਂ ਚੀਜ਼ਾਂ ਬਦਲ ਗਈਆਂ ਫੇਸਬੁੱਕ ਹੋ ਗਿਆ ਲੋਕ ਸੋਸ਼ਲਾਈਜ਼ ਹੋ ਗਏ ਨੇ ਵਾਟਸਅੱਪ ਹੋ ਗਿਆ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਵੀ ਗਰੋ ਵਟਸਅੱਪ ਚੱਲਣ ਕਰਕੇ ਗਰੁੱਪ ਬਣ ਗਏ ਨੇ ਜਿਹਦੇ 'ਤੇ ਕਿ ਮੈਸਿਜ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਬੱਚਿਆਂ ਨੂੰ ਅੱਜ ਸਕੂਲ 'ਚ ਇਹ ਕੰਮ ਮਿਲਿਆ ਉਹ ਕੰਮ ਮਿਲਿਆ ਅੱਜ ਬੱਚਿਆਂ ਦੀ ਅਪਡੇਟ ਦਾ ਮੈਸੇਜ ਵੀ ਸਮਾਰਟਫ਼ੋਨਸ 'ਤੇ ਆਉਣ ਲੱਗ ਪਿਆ ਸਾਨੂੰ ਟੀ ਵੀ ਦੇਖਣ ਦੀ ਲੋੜ ਨਹੀਂ ਕਿਉਂਕਿ ਫੇਸਬੁੱਕ ਦੇ ਉੱਤੇ ਸਾਰੀ ਤਰ੍ਹਾਂ ਦੀਆਂ ਖਬਰਾਂ ਅਤੇ ਹਰ ਇੱਕ ਚੀਜ਼ ਜਿਹੜੀ ਆ ਕਿ ਤੁਹਾਨੂੰ ਉਹਦੀ ਨੌਲੇਜ ਫੇਸਬੁਕ ਤੋਂ ਹੀ ਮਿਲ ਜਾਂਦੀ ਹੈ ਇੰਸਟਾਗ੍ਰਾਮ ਤੋਂ ਮਿਲ ਜਾਂਦੀ ਹੈ ਲੋਕ ਐਨੇ ਸੋਸ਼ਲਾਈਜ਼ ਨਹੀਂ ਸੀ ਹੁੰਦੇ ਪਰ ਅਰ ਹਰ ਅੱਜ ਹਰ ਘਰ ਦੇ ਵਿੱਚ ਲੋਕ ਸੋਸ਼ਲਾਈਜ਼ ਹੋ ਗਏ ਨੇ ਫੋਨਾਂ ਦੇ ਕਰਕੇ ਫ਼ੋਨਾਂ ਦੇ ਹੋਰ ਬੜੇ ਸਿਸਟਮ ਨੇ ਅਗਰ ਤੁਹਾਡਾ ਫ਼ੋਨ ਵੈਸੇ ਨਹੀਂ ਲੱਗ ਰਿਹਾ ਜੇ ਤੁਸੀਂ ਡਾਇਰੈਕਟ ਲਾ ਰਹੇ ਹੋ ਤਾਂ ਤੁਸੀਂ ਵਾਟਸਅੱਪ ਕੌਲ ਵੀ ਕਰ ਸਕਦੇ ਹੋ ਫੇਸਬੁੱਕ ਕੌਲ ਵੀ ਕਰ ਸਕਦੇ ਨੇ ਹੋ ਜਿਹਦੇ ਨਾਲ ਤੁਹਾਨੂੰ ਆਪਣੇ ਪਰੀਏਜਨਾਂ ਨਾਲ ਗੱਲ ਕਰਨ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੁੰਦੀ ਫੋਨਾਂ ਦੇ ਬੜੇ ਫਾਇਦੇ ਨੇ ਜਿਹੜੇ ਨਵੇਂ ਆਏ ਫ਼ੋਨ ਨੇ ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਘਰ ਬੈਠੇ ਪਤਾ ਲੱਗ ਸਕਦਾ ਹੈ ਕਿ ਇੱਕ ਦੇਸ਼ ਦੇ ਕਿਸ ਕੋਨੇ ਵਿੱਚ ਕੀ ਹੋ ਰਿਹਾ ਹੈ ਅਤੇ ਉਸ ਦੀਆਂ ਲਾਈਵ ਤਸ ਤਸਵੀਰਾਂ ਵੀ ਤੁਸੀਂ ਆਪਣੇ ਫ਼ੋਨ ਦੇ ਵਿੱਚ ਦੇਖ ਸਕਦੇ ਹੋ ਫੇਸਬੁੱਕ ਇੰਸਟਾਗ੍ਰਾਮ ਦੇ ਜ਼ਰੀਏ ਇਸ ਕਰਕੇ ਸਮਾਰਟਫ਼ੋਨ ਦੀ ਟੈਕਨੋਲੋਜੀ ਵਿੱਚ ਕਾਫੀ ਤਰ੍ਹਾਂ ਦਾ ਬਦਲਾਵ ਆਏ ਦਿਨ ਆ ਰਿਹਾ ਹੈ ਅਤੇ ਜੋ ਕਿ ਕਈ ਹੱਦ ਤੱਕ ਬਹੁਤ ਅੱਛਾ ਵੀ ਹੈ